ਪੰਜਾਬੀ ਭਾਸ਼ਾ ਦਾ ਇਤਿਹਾਸ ਇਹ ਹੈ ਕਿ ਪੰਜਾਬੀ ਦੇਖੋ ਸਾਡੀ ਮਾਂ ਬੋਲੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਅਸੀਂ ਪੰਜਾਬੀ ਅਤੇ ਪੰਜਾਬੀ ਤੋਂ ਪਤਾ ਲੱਗਦਾ ਕਿ ਸਾ ਇਹ ਸਾਡੀ ਵਿਰਾਸਤ ਤੋਂ ਮਿਲੀ ਹੈ ਸਾਨੂੰ ਸਾਡੇ ਪਤਾ ਲੱਗਦਾ ਸਾਡੇ ਪੰਜਾਬੀ ਬੋਲਣ ਦੇ ਨਾਲ ਹੀ ਪਤਾ ਲੱਗਦਾ ਕਿ ਅਸੀਂ ਪੰਜਾਬੀ ਹਾਂ ਪੰਜਾਬ ਦੇ ਹਾਂ ਪੰਜਾਬ ਦੇ ਰਹਿਣ ਵਾਲੇ ਹਾਂ ਪੰਜਾਬੀ ਦੇ ਨਾਂ ਪੰਜਾਬੀ ਓ ਜਿਹੜੀ ਆ ਉਹ ਸਮੇਂ ਦੇ ਨਾਲ ਬਹੁਤ ਜ਼ਿਆਦਾ ਵਿਕਸਿਤ ਹੋਈ ਹੈ ਪੰਜਾਬੀ ਬੋਲਦਿਆਂ ਜਦੋਂ ਅਸੀਂ ਤਾਂ ਸਾਨੂੰ ਮਾਣ ਮਿਲਦਾ ਸਨਮਾਨ ਮਿਲਦਾ ਪੰਜਾਬ ਦੇ ਨਾਲ ਇਹ ਹੁੰਦਾ ਕਿ ਜਦੋਂ ਜਦੋਂ ਇਹ ਵੀ ਦੇਖਿਆ ਜਾਂਦਾ ਕਿ ਜਦੋਂ ਪੰਜਾਬੀ ਅਸੀਂ ਬੋਲਦੇ ਹੋਵਾਂ ਹੋਈਏ ਜਾਂ ਅਸੀਂ ਕਿਤੇ ਹੋਰ ਪੰਜਾਬ ਦੇਸ਼ ਤੋਂ ਬਾਹਰ ਜਾਈਏ ਕਿਤੇ ਅਤੇ ਉਹ ਜ ਉਹ ਹਿੰਦੀ ਬੋਲਣ 'ਚ ਸਾਨੂੰ ਕਈ ਵਾਰ ਹਿੰਦੀ ਵੀ ਉਹਨਾਂ ਦੇ ਨਾਲ ਬੋਲਣੀ ਪੈਂਦੀ ਹੈ ਪਰ ਸਾਨੂੰ ਕਈ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਪੰਜਾਬੀ ਭਾਸ਼ਾ ਦਾ ਇਤਿਹਾਸ ਤਾਂ ਬਹੁਤ ਹੀ ਗਹਿਰਾ ਹੈ ਪੰਜਾਬੀ ਜਿਹੜੀ ਆ ਸਾਡੀ ਰਗ ਰਗ ਦੇ ਵਿੱਚ ਸਮਾਈ ਹੈ ਪੰਜਾਬੀ ਸਾਡੀ ਮਾਂ ਭਾਸ਼ਾ ਹੈ ਮਾਂ ਬੋਲੀ ਹੈ ਅਤੇ ਵਿਰਾਸਤ ਤੋਂ ਮਿਲੀ ਹੈ ਦੇਖੋ ਗੁਰੂ ਜਿਹੜੇ ਹੈਗੇ ਨੇ ਸਾਡੇ ਪੰਜਾਬ ਦੇ ਦਸ ਗੁਰੂ ਹੋਏ ਹਨ ਅਤੇ ਉਹ ਪੂਰੇ ਪੰਜਾਬ ਦੀ ਵਿਰਾਸਤ ਹੈਗੇ ਸਨ ਪੰਜਾਬ ਦੇ ਹੀ ਰਹਿਣ ਵਾਲੇ ਸਨ ਅਤੇ ਪੰਜਾਬੀ ਭਾਸ਼ਾ ਦੇ ਵਿੱਚ ਹੀ ਲਿਖਦੇ ਬੋਲਦੇ ਸਨ ਜਿਹੜੀ ਉਹਨਾਂ ਨੇ ਗੁਰਬਾਣੀ ਵੀ ਲਿਖੀ ਆ ਉਹ ਵੀ ਪੰਜਾਬੀ ਦੇ ਭਾਸ਼ਾ ਦੇ ਵਿੱਚ ਲਿਖੀ ਗਈ ਹੈ ਪੰਜਾਬੀ ਦੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਪੂਰੀ ਸਿਖਾਉਣੀ ਚਾਹੀਦੀ ਹੈ ਸਮੇਂ ਦੇ ਨਾਲ ਨਾਲ ਇਹ ਬਹੁਤ ਜ਼ਿਆਦਾ ਵਿਕਸਿਤ ਹੋਵੇ ਅਤੇ ਪੰਜਾਬ ਦਾ ਉਦਾਰ ਹੋਵੇ ਪੰਜਾਬ ਦਾ ਕਲਿਆਣ ਹੋਵੇ